ਇੱਕੀ ਨਵੰਬਰ ਉੱਨੀ ਸੌ ਅਠਾਸੀ ਇੱਕੀ ਦਸੰਬਰ ਉੱਨੀ ਸੌ ਇਕਾਨਵੇਂ ਗਿਆਰਾਂ ਮਾਰਚ ਦੋ ਹਜ਼ਾਰ ਤੇਰ੍ਹਾਂ ਪੰਦਰਾਂ ਜਨਵਰੀ ਦੋ ਹਜ਼ਾਰ ਪੰਦਰਾਂ ਉੱਨੀ ਮਾਰਚ ਦੋ ਹਜ਼ਾਰ ਅਠਾਰਾਂ